ਖੁੱਲ੍ਹੇ ਪਾਣੀ ਦੇ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਦੇ ਕੁਝ ਕਾਰਨ ਨੇ ਵੱਡੀਆਂ ਪਾਣੀਆਂ ਜਿਵੇਂ ਕਿ ਤਿਲਕਣ ਵਾਲੀਆਂ ਚਟਾਨਾਂ ਐਲਗੀ ਤੇਜ਼ ਵਹਾਅ ਆਦਿ ਦੇ ਵਿੱਚ ਕਾਫੀ ਰੁਕਾਵਟਾਂ ਹਨ ਸਭ ਤੋਂ ਪਹਿਲਾਂ ਜਦੋਂ ਖੁੱਲ੍ਹੇ ਪਾਣੀ ਦੇ ਵਿੱਚ ਅਸੀਂ ਤੈਰਾਕੀ ਕਰਦੇ ਹਾਂ ਤਾਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਸਰੀਰ ਦੇ ਉੱਤੇ ਕੁਝ ਸਨਸਕਰੀਨ ਕਰੀਮਾਂ ਜੋ ਹੁੰਦੀਆਂ ਹਨ ਉਹ ਲਗਾ ਲੈਣੀਆਂ ਚਾਹੀਦੀਆਂ ਹਨ ਦੂਸਰਾ ਸਾਨੂੰ ਸਨ ਗਲਾਸਿਸ ਤੋਂ ਬਿਨਾ ਤੈਰਾਕੀ ਨਹੀਂ ਕਰਨੀ ਚਾਹੀਦੀ ਕਿਉਂਕਿ ਸੂਰਜ ਦੇ ਨਾਲ ਜਿਹੜੀਆਂ ਪਾਣੀ ਦੇ ਵਿੱਚ ਕਿਰਨਾਂ ਪੈਂਦੀਆਂ ਨੇ ਉਹਨਾਂ ਦਾ ਅੱਖਾਂ ਦੇ ਉੱਤੇ ਬੈਡ ਇਫੈਕਟ ਪੈਂਦਾ ਹੈ ਤੀਸਰਾ ਸਾਨੂੰ ਸਾਹ ਲੈਣ ਦੇ ਲਈ ਆਪਣੇ ਦੇ ਨਾਲ ਗੈਸ ਮਾਸਕ ਵੀ ਭਾਵ ਆਕਸੀਜਨ ਸਿਲੰਡਰ ਵੀ ਰੱਖਣਾ ਚਾਹੀਦਾ ਹੈ ਅਤੇ ਕੁਝ ਕੁ ਅਜਿਹੀਆਂ ਥਾਵਾਂ ਜਿੱਥੇ ਕਿ ਬੜੇ ਬੜੇ ਸਮੁੰਦਰੀ ਜੀਵ ਜਿਵੇਂ ਕਿ ਵੇਲ ਮੱਛ ਮਗਰ ਮੱਛੀਆਂ ਆਦਿ ਸਟਾਰਫਿਸ਼ਾਂ ਆਦਿ ਇਹਨਾਂ ਥਾਵਾਂ ਦੇ ਉੱਤੇ ਵੀ ਸਾਨੂੰ ਸਵੀਮਿੰਗ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਕੁਝ ਵੱਡੀਆਂ ਤਿਲਕਣ ਵਾਲੀਆਂ ਚਟਾਨਾਂ ਜਿਸ ਤਰ੍ਹਾਂ ਕਿ ਜੋ ਰਿਸੀਕੇਸ਼ ਵਿੱਚ ਹਨ ਭਾਵ ਜਿੱਥੇ ਲੋਕ ਤੈਰਾਕੀ ਕਰਦੇ ਹਨ ਤਿਲਕਣ ਵਾਲੀਆਂ ਕੁਝ ਕੁ ਚਟਾਨਾਂ ਹਨ ਤਾਂ ਉਹਨਾਂ ਤੋਂ ਸਾਨੂੰ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ ਤੈਰਾਕੀ ਕਰਨੀ ਚਾਹੀਦੀ ਹੈ ਕਿ ਚਟਾਨਾਂ ਦੇ ਉੱਪਰ ਐਲਗੀ ਦੀ ਬਹੁਤ ਮੋਟੀ ਮੋਟੀ ਤਹਿ ਹੁੰਦੀ ਹੈ ਜਿਸ ਦੇ ਨਾਲ ਚਟਾਨ ਦਾ ਸਹੀ ਪਤਾ ਨਹੀਂ ਲੱਗਦਾ ਅਤੇ ਅਸੀਂ ਕੋਈ ਨਾ ਕੋਈ ਦੁਰਘਟਨਾ ਕਰਵਾ ਬੈਠਦੇ ਹਾਂ ਇਹਨਾਂ ਥਾਵਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਸਾਨੂੰ ਤੈਰਾਕੀ ਕਰਨੀ ਚਾਹੀਦੀ ਹੈ ਅਤੇ ਕੁਝ ਕੁ ਤੇਜ਼ ਵਹਾਅ ਵਾਲੀ ਥਾਵਾਂ ਜਿਸ ਤਰ੍ਹਾਂ ਕਿ ਹਰੀਦੁਆਰ ਦੇ ਵਿੱਚ ਸ਼੍ਰੀ ਗੰਗਾ ਜੀ ਦਾ ਪ੍ਰਭਾਵ ਇੰਨਾ ਤੇਜ਼ ਹੈ ਜਿਸ ਤਰ੍ਹਾਂ ਹਰ ਕੀ ਪੌੜੀ ਦੇ ਉੱਤੇ ਜੋ ਉਸ ਦੇ ਰਸਤੇ ਵਿਚ ਆਉਂਦਾ ਹੈ ਉਹ ਸਾਰਿਆਂ ਨੂੰ ਆਪਣੇ ਵਹਾਅ ਦੇ ਨਾਲ ਰੋੜ ਕੇ ਲੈ ਜਾਂਦਾ ਹੈ